ਵਾਤਾਵਰਨ ਪ੍ਰਦੂਸ਼ਨ ਦਾ ਮੁੱਦਾ ਇਸ ਸਮੇਂ ਬਹੁਤ ਵੱਡੇ ਪੱਧਰ 'ਤੇ ਦੇਖਿਆ ਜਾ ਸਕਦਾ ਹੈ ਹਵਾ ਪ੍ਰਦੂਸ਼ਣ ਪਾਣੀ ਪ੍ਰਦੂਸ਼ਣ ਮਿੱਟੀ ਪ੍ਰਦੂਸ਼ਣ ਇਹ ਬਹੁਤ ਵੱਧ ਚੁੱਕੇ ਹਨ ਸਾਡੇ ਫੈਕਟਰੀਆਂ ਦਾ ਗੰਦਾ ਪਾਣੀ ਕੂੜਾ ਕਰਕਟ ਜੋ ਪਾਣੀ ਨੂੰ ਬਹੁਤ ਜ਼ਿਆਦਾ ਖ਼ਰਾਬ ਕਰ ਰਹੇ ਹਨ ਜਿਸ ਨਾਲ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਰਹੀਆਂ ਹਨ ਸਕਿਨ ਨੂੰ ਲੈ ਕੇ ਬਹੁਤ ਵੱਡੇ ਪੱਧਰ 'ਤੇ ਰੋਗ ਵੇਖੇ ਜਾ ਸਕਦੇ ਹਨ ਸਾਡੇ ਜੋ ਖੇਤ ਖੇਤਾਂ ਵਿੱਚ ਫ਼ਸਲਾਂ 'ਤੇ ਜੋ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਉਹਨਾਂ ਨਾਲ ਫ਼ਸਲਾਂ ਦੀ ਕੁਆਲਿਟੀ ਬਹੁਤ ਘੱਟ ਰਹੀ ਹੈ ਜਿਸ ਨਾਲ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਰਹੀਆਂ ਹਨ ਆਵਾਜਾਈ ਦੇ ਸਾਧਨਾਂ ਕਰਕੇ ਬਹੁਤ ਸ਼ੋਰ ਪ੍ਰਦੂਸ਼ਣ ਹੋ ਰਿਹਾ ਹੈ ਹਵਾ ਨੂੰ ਗੰਦਲਾ ਕੀਤਾ ਜਾ ਰਿਹਾ ਹੈ ਜਿਸ ਨਾਲ ਸਾਹ ਸਬੰਧੀ ਬਹੁਤ ਸਾਰੇ ਰੋਗ ਦੇਖੇ ਜਾ ਸਕਦੇ ਹਨ ਸਾਹ ਲੈਣ 'ਚ ਬਹੁਤ ਦਿੱਕਤ ਆਉਂਦੀ ਹੈ ਲੀਵਰ 'ਚ ਇਨਫੈਕਸ਼ਨ ਹੁੰਦੀ ਹੈ ਦਿਲ ਦੇ ਰੋਗ ਲੱਗ ਜਾਂਦੇ ਨੇ ਇਸ ਲ ਕਰਕੇ ਸਾਨੂੰ ਬਹੁਤ ਵੱਡੇ ਪੱਧਰ 'ਤੇ ਇਹ ਬਿਮਾਰੀਆਂ ਵੇਖਣੀਆਂ ਵੇਖੀਆਂ ਜਾ ਸਕਦੀਆਂ ਹਨ ਤਾਪਮਾਨ ਵਿੱਚ ਬਹੁਤ ਵੱਡੇ ਪੱਧਰ 'ਤੇ ਰੁਕਾਵਟ ਵੇਖੀ ਜਾ ਸਕਦੀ ਹੈ ਗਰਮੀ ਵਿੱਚ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਅਤੇ ਸਰਦੀ ਵਿੱਚ ਬਹੁਤ ਜ਼ਿਆਦਾ ਸਰਦੀ ਹੋ ਰਹੀ ਹੈ ਅਤੇ ਰੁੱਖਾਂ ਦੀ ਕਟਾਈ ਕਰਕੇ ਸਾਨੂੰ ਆਕਸੀਜਨ ਦੀ ਕਮੀ ਹੋ ਰਹੀ ਹੈ